ਮੈਂ ਕਿਚਨ 'ਚ ਨਾ ਇੱਕ ਕੱਪ ਦਾ ਸੈੱਟ ਮੰਗਵਾਇਆ ਓਨਲਾਈਨ ਅਤੇ ਉੱਥੋਂ ਨਾ ਮੈਨੂੰ ਬਹੁਤ ਹੀ ਜੇ ਜੇ ਆਪਾਂ ਬਾਜ਼ਾਰ 'ਚ ਜਾਈਏ ਨਾ ਤਾਂ ਉੱਥੇ ਨਹੀਂ ਮਿਲਦੇ ਇਹੋ ਜਿਹੇ ਅਤੇ ਮੈਂ ਨਾ ਓਨਲਾਈਨ ਵੇਖੇ ਉੱਥੇ ਬਹੁਤ ਹੀ ਸੋਹਣੇ ਕੱਪ ਦਾ ਸੈੱਟ ਮਿਲ ਗਿਆ ਮੈਨੂੰ ਅਤੇ ਮੈਂ ਨਾਲ ਕੋਫੀ ਮਗ ਵੀ ਮੰਗਵਾਉਣੇ ਸੀ ਅਤੇ ਕੱਪ ਤਾਂ ਇੰਨੇ ਜ਼ਿਆਦਾ ਸੋਹਣੇ ਹੈਗੇ ਸੀ ਵੀ ਪੁੱਛੋ ਹੀ ਨਾ ਉਹਦੇ ਵਿੱਚ ਨਾ ਉਹਦੇ ਉੱਤੇ ਗੋਲਡਨ ਲਾਈਨ ਹੈਗੀ ਸੀ ਅਤੇ ਉਹਦੇ ਸ਼ੇਪ ਵੀ ਅਲੱਗ ਹੈਗੀ ਸੀ ਅਤੇ ਕਿਚਨ ਵਿੱਚ ਪਏ ਵੀ ਬਹੁਤ ਸੋਹਣੇ ਲੱਗਦੇ ਨੇ ਮੈਂ ਪਹਿਲਾਂ ਬਾਜ਼ਾਰ ਵਿੱਚ ਟਰਾਈ ਕੀਤਾ ਸੀ ਉੱਥੇ ਦਾ ਨਾ ਮੈਨੂੰ ਨਜ਼ਾਰਾ ਵਧੀਆ ਨਹੀਂ ਲੱਗਿਆ ਅਤੇ ਫਿਰ ਮੈਂ ਸੋਚਿਆ ਓਨਲਾਈਨ ਮੰਗਵਾ ਲੈਦੀ ਹਾਂ ਫਿਰ ਮੈਂ ਓਨਲਾਈਨ ਮੰਗਵਾਇਆ ਅਤੇ ਉੱਥੇ ਨਾ ਮੈਨੂੰ ਕੱਪ ਦਾ ਸੈੱਟ ਬਹੁਤ ਬਹੁਤ ਬਹੁਤ ਵਧੀਆ ਮਿਲ ਗਿਆ ਅਤੇ ਮੈਨੂੰ ਨਾ ਉੱਥੋਂ ਲੈ ਕੇ ਕੱਪ ਅਤੇ ਸੈਟਿਸਫੈਕਸ਼ਨ ਵੀ ਬਹੁਤ ਜ਼ਿਆਦਾ ਹੋਈ ਹੈ ਅਤੇ ਮੈਂ ਓ ਉੱਥੇ ਨਾ ਵੇਖੀ ਵੀ ਅਲੱਗ ਹੀ ਸ਼ੇਪ ਹੈਗੀ ਸੀ ਉਹਨਾਂ ਦੀ ਅਤੇ ਰੰਗ ਵੀ ਬਹੁਤ ਸੋਹਣਾ ਮਿਲ ਗਿਆ ਕੁ ਉੱਥੇ ਓਲਾਈਨ ਵੇਖੇ ਤਾਂ ਉਹਦੇ ਵਿੱਚ ਨਾ ਕੁਝ ਕੱਪ ਵੱਡੇ ਸੀ ਕੁਛ ਛੋਟੇ ਸੀ ਮੀਡੀਅਮ ਸਾਈਜ਼ ਸੀ ਮੈਨੂੰ ਤਾਂ ਮੀਡੀਅਮ ਹੀ ਚਾਹੀਦਾ ਸੀ ਇਸ ਲਈ ਮੈਂ ਨਾ ਮੀਡੀਅਮ ਹੀ ਮੰਗਵਾਏ ਹੈ ਅਤੇ ਉਹ ਨਾ ਕੋਫੀ ਵੀ ਉਹਦੇ ਨਾਲ ਪਏ ਸੀ ਅਤੇ ਮੈਂ ਉਹ ਵੀ ਮੈਨੂੰ ਵਧੀਆ ਲੱਗਿਆ ਅਤੇ ਮੈਂ ਉਹ ਵੀ ਮੰਗਵਾ ਲਏ ਨਾਲ ਅਤੇ ਕੋਫੀ ਮਗ ਵੀ ਮੈਨੂੰ ਬਹੁਤ ਹੀ ਜ਼ਿਆਦਾ ਸੋਹਣੇ ਲੱਗੇ ਅਤੇ ਉਹਨਾਂ ਦਾ ਵੀ ਨਹੀਂ ਇੱਕ ਅਲੱਗ ਸਾਈਜ਼ ਅਲੱਗ ਸ਼ੇਪ ਹੈਗੀ ਹੈ ਅਤੇ ਡਿਫਰੈਂਟ ਅਤੇ ਕਿਚਨ ਵਿੱਚ ਪਏ ਵੀ ਸੋਹਣੀ ਲੱਗਦੀ ਪਈ ਹੈ ਕਰੋਕਰੀ ਅਤੇ ਮੈਨੂੰ ਉੱਥੋਂ ਮੰਗਵਾ ਕੇ ਸਰਟੀਫਿਕੇਸ਼ਨ ਵੀ ਵਧੀਆ ਮਿਲੀ ਹੈ ਅਤੇ ਅਤੇ ਮੈਂ ਚਾਹੁੰਦੀ ਹਾਂ ਕਿ ਸ਼ਾਇਦ ਕੱਪ ਦਾ ਇੱਕ ਸੈੱਟ ਹੋਰ ਮੰਗਵਾ ਲਵਾਂ ਕਿਉਂਕਿ ਮੈਂ ਫਿਰ ਨਾ ਬਾਜ਼ਾਰ ਵਿੱਚ ਕੀਤਾ ਸੀ ਟਰਾਈ ਉੱਥੇ ਨਹੀਂ ਵਧੀਆ ਮਿਲੇ ਇੰਨੇ ਜ਼ਿਆਦਾ